ਹੈਲੋ ਮੈਮ ਸਤਿ ਸ਼੍ਰੀ ਅਕਾਲ ਮੈਂ ਵਧੀਆ ਤੁਸੀਂ ਦੱਸੋ ਮੈਮ ਮੈਂ ਇਸ ਕਰਕੇ ਕੋਲ ਕੀਤੀ ਸੀ ਤੁਹਾਨੂੰ ਕਿ ਤੁਹਾਡੇ ਕੋਲ ਕੋਈ ਨੋਟੀਫਿਕੇਸ਼ਨ ਆਈ ਆ ਪ੍ਰੀ ਨਰਸਰੀ 'ਚ ਐਡਮੀਸ਼ਨ ਦੀ ਮੈਮ ਮੈਂ ਸੋਚਦੀ ਸੀਗੀ ਕਿ ਸ਼ਿਵਾਲਿਕ ਵਧੀਆ ਸਕੂਲ ਹੈ ਤਾਂ ਮੈਂ ਆਪਣੀ ਬੇਟੀ ਦੀ ਇੱਥੇ ਐਡਮੀਸ਼ਨ ਕਰਵਾ ਦੇਵਾਂ ਹਾਂਜੀ ਮੈਮ ਕਿੰਨੀ ਕੁ ਤੁਸੀਂ ਦੱਸ ਸਕਦੇ ਓ ਮੈਨੂੰ ਕਿੰਨੀ ਕੁ ਪੈ ਜਾਂਦਾ ਹੈ ਫਿਰ ਵੀ ਠੀਕ ਹੈ ਮੈਂ ਨਾ ਕੈਮਬ੍ਰੇਜ ਵੀ ਪੁੱਛ ਕੇ ਆਈ ਸੀਗੀ ਹੈਗਾ ਤਾਂ ਉਹ ਵੀ ਸੀ ਬੀ ਐੱਸ ਸੀ ਹੈ ਜਿੱਦਾਂ ਕਿ ਇਹ ਸ਼ਿਵਾਲਿਕ ਹੈ ਅਤੇ ਉਹ ਕਹਿ ਰਹੇ ਸੀਗੇ ਕਿ ਥਰਟੀ ਅਪ੍ਰੋਕਸੀਮੇਟ ਥਰਟੀ ਤ ਚਲ ਜਾਂਦਾ ਆ ਹਾਂਜੀ ਮੈਮ ਸੋਚਦੀ ਸੀਗੀ ਕਿ ਸ਼ਿਵਾਲਿਕ ਹੀ ਨਾ ਕਿ ਓਹੀ ਬੈਸਟ ਹੈ ਤਾਂ ਮੈਂ ਕਿਹਾ ਚਲੋ ਤੁਹਾਡੀ ਵੀ ਸਲਾਹ ਲੈ ਲਈ ਜਾਵੇ ਕਿਉਂਕਿ ਤੁਹਾਡੀ ਤਾਂ ਬੇਟੀ ਉੱਥੇ ਪੜ੍ਹਦੀ ਆ ਹਾਂਜੀ ਹੋਰ ਠੀਕ ਆ ਸਭ ਮੈਮ ਓਕੇ ਚਲੋ ਠੀਕ ਹੈ ਮੈਮ